ਪੰਜਾਬੀ ਲੋਕਾਂ ਦੀ ਆਪਣੀ ਹੀ ਪਛਾਣ ਹੁੰਦੀ ਹੈ ਜਿਸ ਤਰ੍ਹਾਂ ਪੰਜਾਬੀ ਪਹਿਰਾਵੇ ਤੋਂ ਪਛਾਣਿਆ ਜਾਂਦਾ ਹੈ ਉਸੇ ਤਰ੍ਹਾਂ ਪੰਜਾਬੀ ਭਾਸ਼ਾ ਤੋਂ ਵੀ ਅਸੀਂ ਪਛਾਣ ਸਕਦੇ ਹਾਂ ਕਿ ਇਸ ਇਸ ਪੰਜਾਬ ਦੇ ਕਿਸ ਖੇਤਰ ਨਾਲ ਸੰਬੰਧਤ ਹੈ ਪੰਜਾਬ ਰਾਜ ਵਿੱਚ ਵੀ ਅਲੱਗ ਖੇਤਰ ਹਨ ਜਿਵੇਂ ਮਾਝਾ ਮਾਲਵਾ ਦੁਆਬਾ ਇਸੇ ਤਰ੍ਹਾਂ ਮਾਝੀ ਮਲਵਈ ਦੁਆਬੀ ਪੋਠੋਹਾਰੀ ਅਤੇ ਪੋ ਪੁਆਂਦੀ ਭਾਸ਼ਾ ਬੋਲੀ ਜਾਂਦੀ ਹੈ ਮਾਝਾ ਮਾਝੀ ਭਾਸ਼ਾ ਨੂੰ ਟਕਸਾਲੀ ਭਾਸ਼ਾ ਵੀ ਕਿਹਾ ਜਾਂਦਾ ਹੈ ਜਦੋਂ ਅਸੀਂ ਆਮ ਬੋਲ ਚਾਲ ਵਿੱਚ ਭਾਸ਼ਾ ਬੋਲਦੇ ਹਾਂ ਅਸੀਂ ਆਪਣੇ ਇਲਾਕੇ ਦਾ ਸਬੰਧਤ ਸਬੰਧ ਪ੍ਰਗਟ ਕਰਦੇ ਹਾਂ ਕਿ ਅਸੀਂ ਕਿੱਥੋਂ ਦੀ ਭਾਸ਼ਾ ਬੋਲਦੇ ਹਾਂ ਟਕਸਾਲੀ ਜਾਂ ਮਾਝੀ ਭਾਸ਼ਾ ਨੂੰ ਸਰਕਾਰੀ ਕਾਗਜ਼ਾਂ ਕਾਗਜ਼ਾਂ ਟੀ ਵੀ ਰੇਡੀਓ ਅਤੇ ਅਖ਼ਬਾਰਾਂ 'ਤੇ ਵਰਤੋਂ ਕੀਤੀ ਜਾਂਦੀ ਹੈ ਭਾਸ਼ਾ ਹੀ ਸਾਡੀ ਪਹਿਚਾਣ ਬਣ ਚੁੱਕੀ ਹੈ